ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਮੈਂ ਬਾਹਰੋਂ ਆਇਆ ਜੀ ਆਪਣਾ ਨੰਬਰ ਮਿਲਿਆ ਤਾ ਜਗਤਾਰ ਸਿੰਘ ਤੋਂ ਹਾਂਜੀ ਯਾਦਵਿੰਦਰ ਨੂੰ ਹੀ ਲਾਇਆ ਵੀਰ ਮੈਂ ਫੋਨ ਆਪਾਂ ਨੇ ਵੀਰੇ ਉਰੇ ਆਉਣਾ ਸੀ ਘੁੰਮਣ ਵਾਸਤੇ ਬਾਰ੍ਹਵੇਂ ਮਹੀਨੇ ਵਿੱਚ ਆਪਣੇ ਉਰੇ ਕਿਹੜੀਆਂ ਕਿਹੜੀਆਂ ਜਗ੍ਹਾ ਵੀਰੇ ਘੁੰਮਣ ਵਾਸਤੇ ਮੇਨ ਜਗ੍ਹਾ ਸ਼ਹੀਦੀ ਸ਼ਾਨ ਸ਼ਹੀਦੀ ਸਥਾਨ ਠੀਕ ਆ ਜੀ ਹਾਂਜੀ ਜਿੱਥੇ ਨੀਹਾਂ 'ਚ ਚਿਣਿਆ ਤਾਂ ਜੀ ਠੀਕ ਆ ਜੀ ਅੱਛਾ ਜੀ ਨਹੀਂ ਲੇ ਠੀਕ ਹੈ ਜੀ ਠੀਕ ਆ ਠੀਕ ਆ ਵੀਰ ਕੋਈ ਗੱਲ ਨਹੀਂ ਮੈਂ ਤੁਹਾਡਾ ਨੰਬਰ ਸੇਵ ਕਰ ਲੈਂਦਾ ਵੀਰੇ ਵਿੱਚ ਫੋਨ 'ਚ ਜਦ ਵੀ ਮੈਂ ਤੁਹਾਡੇ ਕੋਲ ਇੱਧਰ ਆਉਂਗਾ ਮੈਂ ਬਾਰਵੇਂ ਮਹੀਨੇ 'ਚ ਆਉਂਦਾ ਘੁੰਮਣ ਵਾਸਤੇ ਮੈਂ ਤੁਹਾਡੇ ਨਾਲ ਕਨੈਕਟ ਕਰੂੰਗਾ ਹਾਂਜੀ ਨੰਬਰ ਮੇਰਾ ਨੰਬਰ ਮੇਰਾ ਤੁਸੀਂ ਓਕੇ ਕਰ ਲਓ ਲਿਖ ਲਓ ਡੈਅਰੀ 'ਚ ਮੇਰਾ ਹਾਂਜੀ ਹੋਰ ਯਾਦਵਿੰਦਰ ਜੀ ਠੀਕ ਠਾਕ ਹੈ ਸਾਰਾ ਹਾਂਜੀ ਅਤੇ ਉਹ ਆਪਣਾ ਆਪਣਾ ਧਿਆਨ 'ਚ ਰੱਖਿਓ ਜੀ ਇਹ ਆਪਣਾ ਕਿਤੇ ਹੋਰ ਪਾਸੇ ਨਾ ਲੰਘ ਜਿਓ ਮੈਂ ਵੀਰੇ ਦੋ ਤਿੰਨ ਦਿਨ ਪਹਿਲਾਂ ਫੋਨ ਕਰੂੰਗਾ ਹਾਂਜੀ ਮੈਨੂੰ ਜ਼ਰੂਰ ਘੁੰਮਾ ਘੁੰਮਾਉਣਾ ਵੀਰੇ ਮੇਰਾ ਬਹੁਤ ਮਨ ਕਰਦਾ ਘੁੰਮਣ ਦਾ ਗੁਰਦੁਆਰਾ ਸਾਹਿਬ ਜਿਵੇਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਜੋਤੀ ਸਰੂਪ ਸਾਹਿਬ ਜੀ ਸੀਸਗੰਜ ਸਾਹਿਬ ਜੀ ਮੋਤੀ ਰਾਮ ਮਹਿਰਾ ਵੀਰ ਵੀਰੇ ਸਾਰੇ ਗੁਰਦੁਆਰੇ ਤਸੱਲੀ ਕਰਵਾ ਦਿਓ ਜੀ ਮੈਂ ਵੀਰੇ ਦਰਸ਼ਨ ਕਰਨਾ ਚਾਹੁੰਦਾ ਜੀ ਚਲੋ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ